ਮੈਂ ਇੱਕ ਫਰਿੱਜ ਖਰੀਦਿਆ ਹੈ ਅਤੇ ਇਮਾਨਦਾਰੀ ਨਾਲ਼ ਇਹ ਕਾਫ਼ੀ ਨਿਰਾਸ਼ਾਜਨਕ ਰਿਹਾ ਸਭ ਤੋਂ ਪਹਿਲਾਂ ਇਹ ਰੌਲ਼ਾ ਹੈ ਇਹ ਉੱਚੀ ਤੰਗ ਕਰਨ ਵਾਲੀ ਆਵਾਜ਼ ਬਣਾਉਂਦਾ ਹੈ ਜੋ ਮੈਂ ਅਗਲੇ ਕਮਰੇ ਵਿੱਚੋਂ ਵੀ ਸੁਣ ਸਕਦਾ ਹਾਂ ਇਹ ਮੇਰੀ ਰਸੋਈ ਵਿੱਚ ਇੱਕ ਮਿੰਨੀ ਨਿਰਮਾਣ ਸਾਈਟ ਹੋਣ ਵਰਗਾ ਹੈ ਦੂਜਾ ਇਹ ਬਹੁਤ ਊਰਜਾ ਕੁਸ਼ਲ ਨਹੀਂ ਹੈ ਜਦੋਂ ਤੋਂ ਮੈਨੂੰ ਇਸ ਇਹ ਮਿਲਿਆ ਹੈ ਮੇਰਾ ਬਿਜਲੀ ਦਾ ਬਿੱਲ ਕਾਫ਼ੀ ਵੱਧ ਗਿਆ ਹੈ ਇਹ ਮਹਿਸੂਸ ਹੁੰਦਾ ਹੈ ਕਿ ਇਹ ਹਰ ਸਮੇਂ ਸ਼ਕਤੀ ਨੂੰ ਗੋਵ ਕਰ ਰਿਹਾ ਹੈ ਅਤੇ ਸਭ ਤੋਂ ਮਾੜੀ ਗੱਲ ਇਹ ਹੈ ਕਿ ਇਹ ਚੀਜ਼ਾਂ ਨੂੰ ਇੰਨਾ ਠੰਡਾ ਨਹੀਂ ਰੱਖਦਾ ਜਿੰਨਾਂ ਇਹ ਹੋਣਾ ਚਾਹੀਦਾ ਹੈ ਕਦੇ ਕਦਾਈ ਮੇਰਾ ਭੋਜਨ ਜਿੰਨਾਂ ਚਿਰ ਹੋਣਾ ਚਾਹੀਦਾ ਹੈ ਤਾਜ਼ਾ ਨਹੀਂ ਰਹਿੰਦਾ ਜੋ ਨਿਰਾਸ਼ਾਜਨਕ ਹੁੰਦਾ ਹੈ ਮੈਨੂੰ ਬਿਹਤਰ ਪ੍ਰਦਰਸ਼ਨ ਦੀ ਉਮੀਦ ਸੀ ਅੰਤ ਵਿੱਚ ਫਰਿੱਜ ਤੇਜ਼ੀ ਨਾਲ਼ ਠੰਡਾ ਹੋ ਜਾਂਦਾ ਹੈ ਅਤੇ ਮੈਨੂੰ ਇਸ ਨੂੰ ਆਪਣੀ ਇੱਛਾ ਨਾਲੋਂ ਜ਼ਿਆਦਾ ਵਾਟਰ ਡਰਿਫਟ ਕਰਨਾ ਪੈਂਦਾ ਹੈ ਇਹ ਫਰਿੱਜ ਨੂੰ ਸਹੀ ਢੰਗ ਨਾਲ਼ ਕੰਮ ਕਰਨ ਲਈ ਵਾਧੂ ਕੰਮ ਕਰਨਾ ਦੀ ਤਰ੍ਹਾਂ ਹੁੰਦਾ ਹੈ ਕੁੱਲ ਮਿਲਾ ਕੇ ਮੈਨੂੰ ਆਪਣੀ ਖਰੀਦ 'ਤੇ ਪਛਤਾਵਾ ਹੈ ਮੇਰੀ ਇੱਛਾ ਹੈ ਕਿ ਮੈਂ ਇੱਕ ਵੱਖਰਾ ਫਰਿੱਜ ਚੁਣਿਆ ਹੁੰਦਾ ਜੋ ਸ਼ਾਂਤ ਵਧੇਰੇ ਊਰਜਾ ਕੁਸ਼ਲ ਅਤੇ ਮੇਰੇ ਭੋਜਨ ਨੂੰ ਤਾਜ਼ਾ ਰੱਖਣ ਵਿੱਚ ਬਿਹਤਰ ਹੁੰਦਾ